ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਸਾਡੀ ਜ਼ਿੰਦਗੀ ਵਿੱਚ ਸਾਡੀ ਬਾਈਕਿੰਗ ਅਤੇ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪ੍ਰਭਾਵ ਕੀਤਾ ਹੈ ਜਿੱਦਾਂ ਕਿ ਰੋਜ਼ ਅਸੀਂ ਜਾਂਦੇ ਹਾਂ ਆਉਂਦੇ ਹਾਂ ਰੋਜ਼ ਐਨਾ ਜ਼ਿਆਦਾ ਅਸੀਂ ਖਰਚਾ ਨਹੀਂ ਕਰ ਸਕਦੇ ਇਕੱਲੀ ਬਾਈਕਿੰਗ ਦੇ ਬਾਈਕਿੰਗ ਲਈ ਅਤੇ ਪੈਟਰੋਲ ਲਈ ਅਤੇ ਇਹਨਾਂ ਦੀਆਂ ਕੀਮਤਾਂ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਹੱਦ ਤੱਕ ਭਾਰੂ ਮਾਰ ਕੀਤੀ ਹੈ ਬਹੁਤ ਜ਼ਿਆਦਾ ਲੋਕ ਗਰੀਬ ਹਨ ਅਮੀਰ ਵੀ ਹਨ ਪਰ ਸਭ ਦੀ ਜ਼ਿੰਦਗੀ ਵਿੱਚ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੇ ਪ੍ਰਭਾਵ ਪਾਇਆ ਹੈ ਹਰ ਕੋਈ ਐਨਾ ਜ਼ਿਆਦਾ ਐਨਾ ਜ਼ਿਆਦਾ ਖਰਚਾ ਨਹੀਂ ਝੱਲ ਸਕਦਾ ਰੋਜ਼ ਹਰ ਰੋਜ਼ ਦਾ ਕਿ ਉਹ ਪੈਟਰੋਲ 'ਤੇ ਹੀ ਆਉਣ ਜਾਣ ਦਾ ਖਰਚਾ ਆਪਣਾ ਲਗਾ ਦੇਣ ਜਿੰਨੀ ਕੁ ਉਹ ਦ ਜਿੱਦਾਂ ਹੁਣ ਕੋਈ ਕੰਮ ਕਰਦਾ ਹੈ ਕੋਈ ਸ ਕੋਈ ਕੰਮ ਕਰਦਾ ਜਦੋਂ ਆਉਂਦਾ ਜਾਂਦਾ ਤਾਂ ਉਹ ਪੈਟਰੋਲ ਵਿੱਚ ਹੀ ਨਹੀਂ ਨਾ ਵਰ ਹ ਪੈਟਰੋਲ ਦੀ ਵਰਤੋਂ ਵਿੱਚ ਹੀ ਨਹੀਂ ਆਪਣਾ ਪੈਸਾ ਖਰਾਬ ਕਰ ਸਕਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਇਹਨਾਂ ਕੀਮਤਾਂ ਦੀ ਵੱ ਵੱਧਦੀ ਕੀਮਤ ਨੂੰ ਥੋੜ੍ਹਾ ਜਿਹਾ ਰੋਕਿਆ ਜਾਵੇ ਗਰੀਬਾਂ ਦੀ ਜ਼ਿੰਦਗੀ ਬਾਰੇ ਵੀ ਸੋਚਿਆ ਜਾਵੇ ਕਿ ਉਹ ਜੋ ਵੀ ਜ਼ਿੰਦਗੀ ਕਰਦੇ ਜੋ ਵੀ ਵਰਤੋਂ ਵਿੱਚ ਲਿਆਉਂਦੇ ਹਨ ਉਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਘ ਘੱਟ ਕੀਤਾ ਉਹਨਾਂ 'ਤੇ ਥੋੜ੍ਹਾ ਜਿਹਾ ਇੱਕ ਆਰਥਿਕ ਤੌਰ 'ਤੇ ਥੋੜ੍ਹਾ ਜਿਹਾ ਘੱਟ ਕੀਤਾ ਜਾਵੇ ਆਰਥਿਕ ਤੌਰ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ ਇਹ ਪੈਟਰੋਲ ਸਾਡੀ ਜ਼ਿੰਦਗੀ ਵਿੱਚ ਕਾਫੀ ਜ਼ਿਆਦਾ ਅਹਿਮੀਅਤ ਰੱਖਦਾ ਅਤੇ ਇਸ ਨਾਲ ਅਸੀਂ ਬਹੁਤ ਜ਼ਿਆਦਾ ਆਉਣ ਜਾਣ ਦਾ ਜ ਆਉਣ ਜ ਆ ਜਾ ਸਕਦੇ ਹਾਂ ਅਤੇ ਵੱਧਦੀਆਂ ਕੀਮਤਾਂ ਨੇ ਬਹੁਤ ਜ਼ਿਆਦਾ ਬਾਈਕਿੰਗ 'ਤੇ ਪ੍ਰਭਾਵ ਪਾਇਆ ਹੈ ਅਤੇ ਬਾਲਣ ਦੀ ਜ਼ਿਆਦਾ ਵਰਤੋਂ ਵਾਤਾਵਰਨ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਸਾਡਾ ਵਾਤਾਵਰਨ ਪ੍ਰਦੂਸ਼ਣ ਦਾ ਵਾਯੂਮੰਡਲ ਪ੍ਰਦੂਸ਼ਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਹਵਾ ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੁੰਦੀ ਹੈ ਜਿਸ ਨਾਲ ਅਸੀਂ ਬਹੁਤ ਸਾਰੀਆਂ ਸਾਨੂੰ ਸਾਹ ਦੀਆਂ ਚਮੜੀ ਦੀਆਂ ਬਿਮਾਰੀਆਂ ਲਗਦੀਆਂ ਹਨ ਰੋਗ ਲਗਦੇ ਹਨ ਬਾਲਣ ਦੀ ਜ਼ਿਆਦਾ ਵਰਤੋਂ ਨਾਲ ਵਾਤਾਵਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਲੋਕਾਂ ਵਿੱਚ ਛੋਟੇ ਬੱਚਿਆਂ ਵਿੱਚ ਅੱਖਾਂ 'ਚ ਅੱਖਾਂ ਦੀ ਚਮੜੀ ਦਾ ਰੋਗ ਹੁੰਦਾ ਹੈ ਜਲਣ ਹੁੰਦੀ ਹੈ ਅਤੇ ਵਾਤਾਵਰਨ ਦੀ ਵਰ ਬਾਲਣ ਦੀ ਵਰਤੋਂ ਥੋੜ੍ਹੀ ਜਿਹੀ ਘੱਟ ਕੀਤੀ ਜਾਣੀ ਚਾਹੀਦੀ ਹੈ ਇਸ ਮਾਧਿਅਮ 'ਤੇ ਕੀਤੀ ਜਾਣੀ ਹੈ ਜਾਣੀ ਚਾਹੀਦੀ ਹੈ ਕਿ ਤਾਂ ਜੋ ਬਾਲ ਵਾਤਾਵਰਨ ਦਾ ਵੀ ਨੁਕਸਾਨ ਨਾ ਹੋਵੇ ਅਤੇ ਆਪਣਾ ਵੀ ਰੋਜ਼ਮੱਰਾ ਦੀ ਜ਼ਿੰਦਗੀ ਦੀ ਵਰਤੋਂ ਚਲਦੀ ਰਹੇ ਇੱਦਾਂ ਸਾਨੂੰ ਬਾਲਣ ਦੀ ਵਰਤੋਂ ਕਰਨੀ ਚਾਹੀਦੀ ਹੈ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੇ ਬਹੁਤ ਜ਼ਿਆਦਾ ਆਰਥਿਕ ਤੰਗੀ ਪਾਈ ਹੈ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਉਣ ਦੇ ਲਈ ਸਾਨੂੰ ਬਾਲਣ ਦੀ ਥੋੜ੍ਹੀ ਬਹੁਤੀ ਵਰਤੋਂ ਘੱਟ ਕਰਨੀ ਚਾਹੀਦੀ ਹੈ